ਸਤਿ ਸ਼੍ਰੀ ਅਕਾਲ ਸਰ ਮੈਂ ਬਲਵੰਤਰਾਜ ਪਿੰਡ ਪਠਾਨਕੋਟ ਤੋਂ ਬੋਲ ਰਿਹਾ ਕਿਤੇ ਕਿਸਾਨੀ ਨਾਲ ਰਿਲੇਟਡ ਹਾਂ ਇਸ ਕਿਸਾਨੀ ਕਰਨ ਤੋਂ ਇਲਾਵਾ ਕਿ ਮੈਂ ਆਪਣੀ ਫਸਲ ਨੂੰ ਸਾਂਭ ਕੇ ਅਤੇ ਉਸ ਦੇ ਬਾਅਦ ਅਸੀਂ ਆਪਣੇ ਪਸ਼ੂ ਪਾਲਣ ਦਾ ਕੰਮ ਕਰ ਸਕਦੇ ਹਾਂ ਆਰਾਮ ਨਾਲ ਪਸ਼ੂ ਪਾਲਣ ਦਾ ਕੰਮ ਕਰਕੇ ਅਸੀਂ ਦੁੱਧ ਆਪਣਾ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਅਸੀਂ ਚੰਗੇ ਢੰਗ ਨਾਲ ਆਪਣੇ ਪੈਸੇ ਕਮਾ ਸਕਦੇ ਹਾਂ ਉਸ ਤੋਂ ਇਲਾਵਾ ਅਸੀਂ ਪਸ਼ੂਆਂ ਦੇ ਚਾਰੇ ਦਾ ਜਿਹੜਾ ਉਹ ਉਹਦਾ ਪ੍ਰਬੰਧ ਵੀ ਅਸੀਂ ਥੋੜ੍ਹਾ ਇੱਕ ਸੈਡ ਬਿਜ਼ਨਸ ਦੇ ਤੌਰ 'ਤੇ ਕਰ ਸਕਦੇ ਹਾਂ ਅਤੇ ਉਸ ਤੋਂ ਇਲਾਵਾ ਅਸੀਂ ਬਈ ਕਿਸਾਨਾਂ ਦੀ ਜਿਹੜਾ ਹੈ ਉਹ ਮੱਛੀ ਪਾਲਣ ਦਾ ਕੰਮ ਵੀ ਬੜੇ ਆਰਾਮ ਅਤੇ ਸੁਚੱਜੇ ਢੰਗ ਨਾਲ ਥੋੜ੍ਹੀ ਜਿਹੀ ਜਗ੍ਹਾ ਵਿੱਚ ਹੀ ਇੱਕ ਤਲਾਅ ਬਣਾ ਕੇ ਕਰ ਸਕਦਾ ਹੈ ਅਤੇ ਇਸ ਤੋਂ ਇਲਾਵਾ ਕਿਸਾਨ ਜਿਹੜਾ ਹੈ ਉਹ ਰੇਸ਼ਮ ਦੇ ਕੀੜੇ ਵੀ ਘਰ ਵਿੱਚ ਤਿਆਰ ਜਿਹੜੇ ਹੈ ਉਹ ਉਹਦੀ ਖੇਤੀ ਵੀ ਆਰਾਮ ਨਾਲ ਕਰਕੇ ਆਪਣਾ ਘਰ ਦਾ ਗੁਜ਼ਾਰਾ ਅਤੇ ਬੱਚਿਆਂ ਨੂੰ ਪਾਲ ਸਕਦਾ ਹੈ ਅਤੇ ਉਸ ਤੋਂ ਇਲਾਵਾ ਕਿਸਾਨ ਜਿਹੜਾ ਹੈ

ਹੋਰ ਵੀ ਕਈ ਤਰ੍ਹਾਂ ਦੇ ਕਿੱਤੇ ਹਨ ਜਿਹੜੇ ਪੀ ਆਰਾਮ ਨਾਲ ਕਰ ਸਕਦਾ ਹੈ ਧੰਨਵਾਦ ਜੀ